ਅਸੀਂ ਆਪਣੇ ਬਾਗ ਵਿੱਚ ਕਈ ਤਰ੍ਹਾਂ ਦੇ ਪੌਦੇ ਲਗਾ ਸਕਦੇ ਹਾਂ ਜਿਹਨਾਂ ਵਿੱਚ ਅਸੀਂ ਦੇਸੀ ਪੌਦਿਆਂ ਨੂੰ ਵੀ ਸ਼ਾਮਿਲ ਕਰ ਸਕਦੇ ਹਾਂ ਮੈਂ ਆਪਣੀ ਬਗੀਚੀ ਵਿੱਚ ਬਹੁਤ ਤਰ੍ਹਾਂ ਦੇ ਦੇਸੀ ਪੌਦੇ ਲਗਾਏ ਹੋਏ ਹਨ ਜੋ ਕਿ ਸਾਨੂੰ ਬਹੁਤ ਆਸਾਨੀ ਨਾਲ ਮਿਲ ਸਕਦੇ ਹਨ ਅਸੀਂ ਇਹਨਾਂ ਨੂੰ ਕਿਸੇ ਵੀ ਨਰਸਰੀ ਤੋਂ ਆਸਾਨੀ ਨਾਲ ਖਰੀਦ ਸਕਦੇ ਹਾਂ ਇਹਨਾਂ ਵਿੱਚ ਜਿਵੇਂ ਕਿ ਗੁਲਾਬ ਦੇ ਪੌਦੇ ਸੂਰਜ ਮੁਖੀ ਦੇ ਪੌਦੇ ਮਨੀ ਪਲਾਂਟ ਬਹੁਤ ਤਰ੍ਹਾਂ ਦੇ ਪੌਦੇ ਸ਼ਾਮਿਲ ਹੁੰਦੇ ਹਨ ਇਹ ਸਾਡੀ ਬਗੀਚੀ ਦੀ ਸੁੰਦਰਤਾ ਨੂੰ ਵੀ ਵਧਾਉਂਦੇ ਹਨ ਅਤੇ ਨਾਲ ਦੀ ਨਾਲ ਇਹਨਾਂ ਨੂੰ ਅਸੀਂ ਆਸਾਨੀ ਨਾਲ ਆਪਣੀ ਬਗੀਚੀ ਵਿੱਚ ਲਗਾ ਕੇ ਆਪਣੀ ਬਗੀਚੀ ਦੀ ਸੁੰਦਰਤਾ ਨੂੰ ਚਾਰ ਚੰਦ ਲਗਾ ਸਕਦੇ ਹਾਂ ਇਹਨਾਂ ਦੀ ਦੇਖਭਾਲ 'ਤੇ ਵੀ ਕੋਈ ਜ਼ਿਆਦਾ ਖਰਚ ਨਹੀਂ ਆਉਂਦਾ ਅਤੇ ਇਹ ਮਹੱਤਵਪੂਰਨ ਇਸ ਲਈ ਹਨ ਕਿਉਂਕਿ ਜਿੰਨੀ ਹਰਿਆਲੀ ਅਸੀਂ ਆਪਣੇ ਆਸ ਪਾਸ ਰੱਖਾਂਗੇ ਤਾਂ ਉੰਨੀ ਹੀ ਸਾਫ਼ ਆਕਸੀਜਨ ਸਾਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਨਾਲ ਸਾਨੂੰ ਸਾਹ ਲੈਣ ਵਿੱਚ ਆਸਾਨੀ ਆਉਂਦੀ ਹੈ